ਹੈਲੋ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਅਤੇ ਮੈਂ ਖੇਡਾਂ ਦੇ ਖੇਤਰ 'ਤੇ ਕੁਛ ਗੱਲਾਂ ਦੱਸਣੀਆਂ ਚਾਹੁੰਦਾ ਹਾਂ ਕਿ ਜਿਸ ਵਿੱਚ ਸਾਨੂੰ ਪੇਂਡੂ ਖੇਤਰ 'ਤੇ ਬਹੁਤ ਹੀ ਜ਼ਿਆਦਾ ਲਾਭ ਹੁੰਦਾ ਹੈ ਜਿਵੇਂ ਕਿ ਸ਼ਾਮ ਨੂੰ ਸਕੂਲ ਦੇ ਵਿੱਚ ਖੇਡਣ ਜਾਂਦੇ ਹਾਂ ਤਾਂ ਉੱਥੇ ਸਾਨੂੰ ਗੱਲਬਾਤ ਕਰਨ ਦਾ ਵੀ ਬਹੁਤ ਹੀ ਜ਼ਿਆਦਾ ਮੌਕਾ ਮਿਲਦਾ ਹੈ ਇਸ ਲਈ ਸਾਡਾ ਟਾਈਮ ਵੀ ਬਹੁਤ ਆਸਾਨੀ ਨਾਲ ਲੰਘ ਜਾਂਦਾ ਹੈ ਅਤੇ ਸਾਨੂੰ ਖੇਡਾਂ ਖੇਡਾਂ ਵਿੱਚ ਪਤਾ ਹੀ ਨਹੀਂ ਲੱਗਦਾ ਵੀ ਟਾਈਮ ਕਦੋਂ ਲੰਘ ਜਾਂਦਾ ਹੈ ਅਤੇ ਖੇਡਾਂ ਦੇ ਖੇਤਰ ਵਿੱਚ ਬੱਚਾ ਨਸ਼ਿਆਂ ਤੋਂ ਦੂਰ ਰਹਿੰਦਾ ਹੈ ਨਸ਼ਿਆ ਕੰਨੀ ਨੂੰ ਬੱਚੇ ਦਾ ਧਿਆਨ ਨਹੀਂ ਹੁੰਦਾ ਧਿਆਨ ਹੋਣਾ ਵੀ ਨਹੀਂ ਚਾਹੀਦਾ ਨਸ਼ਿਆ ਕੰਨੀ ਨੂੰ ਨਸ਼ੇ ਬਹੁਤ ਮਾੜੀ ਚੀਜ਼ ਹੈ ਖੇਡਾਂ ਸਾਨੂੰ ਇਹ ਚੀਜ਼ਾਂ ਤੋਂ ਬਹੁਤ ਦੂਰ ਰੱਖਦੀਆਂ ਹਨ ਖੇਡਾਂ ਖੇਡਣ ਨਾਲ ਜਿਵੇਂ ਕਿ ਕੋਈ ਟੂਰਨਾਮੈਂਟ ਵਿੱਚ ਬੱਚਾ ਜਿੱਤ ਜਾਂਦਾ ਹੈ ਉਸ ਨਾਲ ਪਿੰਡ ਦਾ ਨਾਮ ਰੋਸ਼ਨ ਹੁੰਦਾ ਹੈ ਅਤੇ ਲਾਭ ਸਾਨੂੰ ਤਾਂ ਹੁੰਦਾ ਹੈ ਜਿਵੇਂ ਕਿ ਸਾਨੂੰ ਇਨਾਮ ਵਜੋਂ ਬੱਚੇ ਨੂੰ ਖੇਡਣ ਅਤੇ ਜਿੱਤਣ ਦੀ ਖੁਸ਼ੀ ਵਿੱਚ ਪੈਸੇ ਮਿਲ ਜਾਂਦੇ ਹਨ ਤਾਂ ਉਸ ਲਈ ਸਾਨੂੰ ਲਾਭ ਹੁੰਦਾ ਹੈ ਅਤੇ ਉਸ ਨਾਲ ਘਰ ਦੀਆਂ ਪ੍ਰੇਸ਼ਾਨੀਆਂ ਵੀ ਦੂਰ ਹੁੰਦੀਆਂ ਹਨ ਖੇਡਾਂ ਨਾਲ ਬੱਚਾ ਨਸ਼ਿਆਂ ਤੋਂ ਦੂਰ ਰਹਿੰਦਾ ਹੈ ਅਤੇ ਇਸ ਲਈ ਖੇਡਾਂ ਦੇ ਖੇਤਰ ਵਿੱਚ ਰਹਿਣਾ ਜ਼ਰੂਰੀ ਹੈ ਕਿ ਬੱਚਾ ਨਸ਼ਿਆਂ ਤੋਂ ਵੀ ਦੂਰ ਰਹਿੰਦਾ ਹੈ ਅਤੇ ਸ਼ਾਮ ਨੂੰ ਜਦੋਂ ਕਿ ਖੇਡਾਂ ਖੇਡਦੇ ਹਾਂ ਤਾਂ ਬੱਚੇ ਆਪਸ ਵਿੱਚ ਗੱਲਬਾਤ ਕਰਦੇ ਹਨ ਇਸ ਨਾਲ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਇਸ ਨੂੰ ਖੇਡਾਂ ਦੇ ਖੇਤਰ ਵਿੱਚ ਜਾਂ ਪੇਡੂ ਖੇਤਰ ਵਿੱਚ ਲੋਕ ਲਾਭ ਹੁੰਦਾ ਹੈ ਜਾਂ ਗੱਲਬਾਤ ਕਰਨਾ ਕਹਿ ਦਿੰਦੇ ਹਨ